ਪੰਜਾਬ ਵਿੱਚ ਤਾਂ ਸਾਡੇ ਸਿੱਖ ਗੁਰੂਆਂ ਦਾ ਹੀ ਜ਼ਿਆਦਾ ਬੋਲ ਬਾਲਾ ਹੈ ਅਤੇ ਲੋਕ ਉਹਨਾਂ ਦੀ ਹੀ ਪੂਜਾ ਕਰਦੇ ਹਨ ਉਨ੍ਹਾਂ ਨੂੰ ਹੀ ਰੱਬ ਸਮਝਦੇ ਹਨ ਬਸ